ਮੈਂ ਸਾਬਨ ਮੈਂ ਸਾਬਿਨ ਖਾਤਿਨ ਬੋਲ ਰਹੀ ਹਾਂ ਮੈਨੇ ਇੱਕ ਟੋਪ ਮਿਸ਼ੋ ਤੋਂ ਔਡਰ ਕਰਾਇਆ ਸੀ ਉਹ ਟੋਪ ਬਹੁਤ ਘ ਘਟੀਆ ਕੁਆਲਿਟੀ ਦਾ ਸੀ ਅਤੇ ਉਸ ਦਾ ਰੰਗ ਵੀ ਜੋ ਮੈਂ ਮੰਗਾਇਆ ਸੀ ਉਸ ਵਰਗਾ ਨਹੀਂ ਸੀ ਅਤੇ ਅਤੇ ਉਸ ਅਤੇ ਉਹ ਟੋਪ ਬਹੁਤ ਲੂਜ਼ ਸੀ ਅ ਅਤੇ ਓ ਅਤੇ ਡਿਲੀਵਰੀ ਬੋਆਏ ਜੋ ਸੀ ਉਸਨੇ ਫ਼ੋਨ ਵੀ ਨਹੀਂ ਚੁੱਕਿਆ ਕਿ ਉਹ ਕਿੱਥੇ ਪੁੱਜਿਆ ਅਤੇ ਅਤੇ ਅਤੇ ਉਹ ਆਇਆ ਵੀ ਲੇਟ ਸੀ ਅਤੇ ਉਸਨੇ ਮੈਨੂੰ ਜਿੱਥੇ ਲੋਕੇਸ਼ਨ ਜੇ ਪਹੁੰਚਣਾ ਸੀ ਉੱਥੇ ਉਹਨਾਂ ਨੇ ਮੈਨੂੰ ਬੁਲਾਇਆ ਵੀ ਨਹੀਂ ਉੱਥੇ ਕਿ ਉਹ ਕਿਤੇ ਹੋਰ ਲੋਕੇਸ਼ਨ 'ਤੇ ਮੈਨੂੰ ਬੁਲਾ ਰਿਹਾ ਹੈ ਆਪਣਾ ਆਪਣਾ ਔਡਰ ਇੱਥੋਂ ਲੈ ਲਓ ਅਤੇ ਮੈਂ ਉਹ ਉਹ ਬਾਤਚੀਤ ਕਰਨ ਵਿੱਚ ਵੀ ਬਹੁਤ ਰੂਟਲੀ ਬੋਲ ਰਿਹਾ ਸੀ ਅਤੇ ਉਸਨੇ ਬਤਮੀਜ਼ੀ ਨਾਲ ਵੀ ਗੱਲ ਕੀਤੀ ਸੀ ਔਰ ਅਗਲੀ ਵਾਰ ਮੈਂ ਜੇ ਅੱਜ ਮੈਂ ਮੈਨੇ ਇਹ ਜੇ ਟੋਪ ਔਡਰ ਕੀਤਾ ਹੈ ਇਹ ਮੈਨੂੰ ਵਾਪਸ ਕਰਾਉਣਾ ਹੈ ਅਤੇ ਮੈਂ ਜੇ ਅਗਰ ਅਗਲੀ ਮੈਨੇ ਜੋ ਔਡਰ ਕਰਾਉਣਾ ਹੋ ਤਾਂ ਮੈਂ ਕਰਾ ਲੂਗੀ ਲੇਕਿਨ ਹਜੇ ਮੈਨੂੰ ਇਹ ਟੋਪ ਨਹੀਂ ਚਾਹੀਦੀ ਹੈ ਬਸ